ਸਿਲਾਈ ਵਿੱਚ ਕਈ ਤਰ੍ਹਾਂ ਦੇ ਅਲੱਗ ਅਲੱਗ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਉੱਨ ਦਾ ਧਾਗਾ ਉਹਦੇ ਨਾਲ ਟੋਪੀ ਬੂਟ ਕੋਟੀਆਂ ਸਵੈਟਰਾਂ ਹੋਰ ਕਾਫੀ ਕੁਛ ਬਣਾਇਆ ਜਾ ਸਕਦਾ ਹੈ ਜਿਵੇਂ ਟੇਬਲ ਕਵਰ ਕੁਰਸੀਆਂ ਕਵਰ ਟੀਵੀ ਕਵਰ ਸਭ ਕੁਛ ਸਾਰੇ ਉੱਨ ਦੇ ਨਾਲ ਸਿਲਾਈਆਂ ਅਤੇ ਕਰੋਸ਼ੀਆ ਦੁਆਰਾ ਬਣਾਇਆ ਜਾ ਸਕਦੇ ਹਨ ਅਤੇ ਜਿਹੜੇ ਸਿਲਕ ਦਾ ਧਾਗਾ ਆ ਉਹਦੇ ਸਾੜੀਆਂ ਦੇ ਯੂਜ਼ ਹੁੰਦਾ ਵੈ ਅਤੇ ਹੋਰ ਕਈ ਵਧੀਆ ਕੰਮਾਂ ਲਈ ਯੂਜ਼ ਹੁੰਦਾ ਜਿਵੇਂ ਕਿ ਸੂਟਾਂ 'ਤੇ ਕਢਾਈ ਕੀਤੀ ਜਾਂਦੀ ਹੈ ਰੇਸ਼ਮੀ ਧਾਗੇ ਨੇ ਰੇਸ਼ਮੀ ਧਾਗਿਆਂ ਦੇ ਨਾਲ ਵੀ ਫਰੇਮ ਲਗਾ ਕੇ ਹੱਥ ਦੇ ਨਾਲ ਅਸੀਂ ਕਢਾਈ ਕਰਦੇ ਹਾਂ ਬਹੁਤ ਸੋਹਣੀ ਫਲਾਵਰ ਜੋ ਮਰਜ਼ੀ ਅਸੀ ਉਹਦੇ ਨਾਲ ਬਣਾ ਸਕਦੇ ਹਾਂ ਪਟ ਦਾ ਧਾਗਾ ਉਹ ਵੀ ਸੂਈ ਧਾਗੇ ਦੇ ਨਾਲ ਅਸੀਂ ਹੱਥ ਦੇ ਨਾਲ ਕਢਾਈ ਦੇ ਵਿੱਚ ਮਤਲਬ ਕਾਫੀ ਉਹਦੇ ਨਾਲ ਡਿਜ਼ਾਇਨ ਪੈਂਦੇ ਹਨ ਫਿਰ ਗੋਟਾ ਪੱਟੀ ਦਾ ਧਾਗਾ ਹੁੰਦਾ ਉਹਦੇ ਨਾਲ ਅਸੀਂ ਚੁੰਨੀਆਂ ਡੈਕੋਰੇਟ ਕਰ ਸਕਦੇ ਹਾਂ ਪੰਜਾਬੀ ਸੂਟ ਬਣਾ ਸਕਦੇ ਹਾਂ ਫੁਲਕਾਰੀ ਦੇ ਸੂਟ ਬਣਾ ਸਕਦੇ ਹਾਂ ਹੋਰ ਜਿਹੜਾ ਜੁੱਤੀਆਂ ਵੀ ਡੈਕੋਰੇਟ ਪਰਸ ਵੀ ਗੋਟਾ ਪੱਟੀ ਨਾਲ ਯੂਜ਼ ਹੁੰਦੇ ਆ ਫਿਰ ਵਿਆਹ 'ਤੇ ਜਿਹੜੀ ਪੱਟੜੀ ਬਣਾਉਂਦੇ ਆ ਪੱਟੀ ਡੈਕੋਰੇਟ ਹੁੰਦੀ ਜਾਗੋ ਦੀ ਉਹਦੇ 'ਤੇ ਵੀ ਗੋਟਾ ਪੱਟੀ ਯੂਜ਼ ਕੀਤੀ ਜਾਂਦੀ ਹੈ ਅਤੇ ਇੱਕ ਹੋਰ ਕਾਫੀ ਤਰ੍ਹਾਂ ਦੇ ਧਾਗੇ ਹੁੰਦੇ ਹਨ ਜਿਹਦੇ ਨਾਲ ਅਸੀਂ ਕੋਟਨ ਦਾ ਧਾਗਾ ਹੁੰਦਾ ਜਿਹਦੇ ਨਾਲ ਅਸੀਂ ਆਪਣੇ ਸੂਟ ਸਿਲ ਸਕਦੇ ਹਾਂ ਮਸ਼ੀਨ ਦੇ ਨਾਲ ਸੂਟ ਸਿਲਦੇ ਹਾਂ ਅਤੇ ਬੱਚਿਆਂ ਦੇ ਕੱਪੜੇ ਸੀਅ ਸਕਦੇ ਹਾਂ ਅਤੇ ਜਿਹੜੇ ਪੱਕੇ ਧਾਗੇ ਹੁੰਦੇ ਨੇ ਉਹਨਾਂ 'ਤੇ ਬਾਕਸ ਵਗੈਰਾ ਲਗਾ ਕੇ ਉਹਨੂੰ ਫੁਟਬਾਲ ਵਗੈਰਾ ਸੀਨ ਦੇ ਕੰਮ ਆਉਂਦੇ ਨੇ ਅਤੇ ਹੋਰ ਕਾਫੀ ਤਰ੍ਹਾਂ ਦੇ ਧਾਗੇ ਹੁੰਦੇ ਨੇ ਜਿਹੜੇ ਕਿ ਮਤਲਬ ਅਸੀਂ ਡੇਲੀ ਰੂਟੀਨ 'ਚ ਵੀ ਯੂਜ ਕਰਦੇ ਹਾਂ ਅਤੇ ਆਪਣੇ ਹਰ ਤਰ੍ਹਾਂ ਦੇ ਕੰਮਾਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਆ ਧੰਨਵਾਦ